ਬਹੁਤੇ ਅਜਿਹੇ ਪੰਛੀ ਜਿਹੜੇ ਸਾਡੇ ਸਾਹਮਣੇ ਨਹੀਂ ਆਉਂਦੇ ਅਸੀਂ ਉਹਨਾਂ ਨੂੰ ਕਿਸੇ ਰੁੱਖ ਜਾਂ ਕੰਧ ਦੇ ਉਹਲੇ ਹੋ ਕੇ ਹੀ ਦੇਖਦੇ ਹਾਂ ਇਹ ਪੰਛੀ ਆਮ ਪੰਛੀਆਂ ਨਾਲੋਂ ਬੜੇ ਤਰੀਕਿਆਂ ਦੇ ਨਾਲ ਅਲੱਗ ਹੁੰਦੇ ਹਨ ਇਹਨਾਂ ਦੀ ਜੇਕਰ ਅਸੀਂ ਇੱਕ ਆਮ ਪੰਛੀ ਦੇ ਨਾਲ ਤੁਲਨਾ ਕਰੀਏ ਤਾਂ ਇਹ ਬਹੁਤ ਹੀ ਚੰਗੇ ਤਰੀਕੇ ਨਾਲ ਆਪਦਾ ਰਹਿਣ ਸਹਿਣ ਖਾਣ ਪਾਨ ਆਦਿ ਤਰੀਕੇ ਅਪਣਾਉਂਦੇ ਹਨ